ਮੈਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਫਤਿਹ ਮੈਂ ਜੇਕਰ ਆਪਣੇ ਜਿਲ੍ਹੇ ਦੀ ਗੱਲ ਕਰਾਂ ਤਾਂ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਜਿਹੜੀ ਧਰਤੀ ਹੈ ਬਹੁਤ ਪਵਿੱਤਰ ਧਰਤੀ ਹੈ ਅਤੇ ਇੱਥੇ ਬਹੁਤ ਸਾਰੇ ਗੁਰਦੁਆਰੇ ਹਨ ਜਿਵੇਂ ਕਿ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਸ਼ੀਸ਼ਗੰਜ ਗੁਰਦੁਆਰਾ ਅਤੇ ਫਤਿਹਗੜ੍ਹ ਸਾਹਿਬ ਦੀ ਜਿਹੜੀ ਧਰਤੀ ਹੈ ਬਹੁਤ ਪਵਿੱਤਰ ਧਰਤੀ ਹੈ ਇੱਥੇ ਦਸੰਬਰ ਮਹੀਨੇ ਵਿੱਚ ਸਿੰਘ ਸਭਾ ਲੱਗਦੀ ਹੈ ਜਿੱਥੇ ਕਿ ਦੁਨੀਆਂ ਭਰ ਦਾ ਬਹੁਤ ਸਾਰਾ ਇਕੱਠ ਹੁੰਦਾ ਹੈ ਅਤੇ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਅਤੇ ਇੱਥੇ ਦਾ ਇਤਿਹਾਸ ਪੜ੍ਹਦੇ ਨੇ ਸੁਣਦੇ ਨੇ ਅਤੇ ਉਸ ਤੋਂ ਬਾਅਦ 'ਚ ਇੱਥੇ ਫਤਿਹਗੜ੍ਹ ਸਾਹਿਬ ਵਿਖੇ ਇੱਕ ਰੋਜ਼ਾ ਸ਼ਰੀਫ ਹੈ ਜਿੱਥੋਂ ਕਿ ਪਾਕਿਸਤਾਨ ਤੋਂ ਵੀ ਲੋਕ ਆ ਕੇ ਮੱਥਾ ਟੇਕ ਟੇਕਦੇ ਨੇ ਉੱਥੇ ਆ ਕੇ ਅਤੇ ਇੱਕ ਆਪਣੇ ਮੁਗਲਾਂ ਦੇ ਟਾਈਮ ਦਾ ਇੱਕ ਕਿਲ੍ਹਾ ਬਣਿਆ ਹੋਇਆ ਹੈ ਜਿਸ ਨੂੰ ਹੁਣ ਕਿ ਜਿੱਦਾਂ ਆਪਣੇ ਆਮ ਖਾਸ ਬਾਗ ਦਾ ਨਾਮ ਦਿੱਤਾ ਗਿਆ ਹੈ ਅਤੇ ਮੇਰੇ ਇਹੀ ਸੁਝਾਅ ਨੇ